ਸਾਡੇ ਇਲਾਕੇ ਵਿੱਚ ਗਰੀਬੀ ਅਤੇ ਬੇਰੁਜ਼ਗਾਰੀ ਕਿੱਦਾਂ ਦੇ ਨਾਮ ਹਨ ਜਿਨ੍ਹਾਂ ਕਰਕੇ ਅਪਰਾਧ ਬਹੁਤ ਹੀ ਤਰੀਕੇ ਨਾਲ ਹੁੰਦੇ ਹਨ ਕਿਉਂਕਿ ਲੋਕ ਬੇਰੁਜ਼ਗਾਰ ਹੁੰਦੇ ਹਨ ਉਹਨਾਂ ਕੋਲ ਇੰਨਾ ਪੈਸਾ ਨਹੀਂ ਹੁੰਦਾ ਕਿ ਉਹ ਆਪਣਾ ਰੋਜ਼ੀ ਰੋਟੀ ਦਾ ਕੰਮ ਕਰ ਸਕਣ ਜਿਹਦੇ ਕਰਕੇ ਉਹ ਚੋਰੀ ਡਾਕੇ ਅਤੇ ਬਾਕੀ ਦਾ ਸਾਧਨ ਲੈਂਦੇ ਹਨ